ਭਾਰਤ ਵਿੱਚ ਸਭ ਤੋਂ ਜ਼ਿਆਦਾ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਬੇਰੁਜ਼ਗਾਰੀ ਆਉਂਦੀ ਹੈ ਜੀ ਸਾਡੀ ਠੀਕ ਹੈ ਜਿਵੇਂ ਬੇਰੁਜ਼ਗਾਰੀ ਜਿਵੇਂ ਪੜ੍ਹ ਲਿਖ ਜਾਂਦਾ ਬੱਚੇ ਨੂੰ ਜੋਬ ਨਹੀਂ ਮਿਲਦੀ ਬੰਦੇ ਨੂੰ ਤਾਂ ਉਹ ਦਰ ਦਰ 'ਤੇ ਭੜਕਦਾ ਫਿਰਦਾ ਕਦੇ ਇੱਧਰ ਜਾਂਦਾ ਕਦੇ ਉੱਧਰ ਅਤੇ ਤਾਂ ਵੀ ਨਹੀਂ ਉਹਨੂੰ ਪੜ੍ਹ ਲਿਖ ਕੇ ਵੀ ਹੋ ਕੇ ਵੀ ਨਹੀਂ ਜੋਬ ਮਿਲਦੀ ਇਹ ਜੀ ਅਤੇ ਦੂਜੀ ਵਾਰ ਇਹ ਗੱਲ ਆਈ ਜਿਵੇਂ ਸਾਡੇ ਹੁਣ ਕਣਕ ਵਗੈਰਾ ਇੱਧਰ ਬੀਜੀ ਜਾਂਦੀ ਆ ਅਤੇ ਉਹਦੇ ਵਿੱਚ ਕਾਰਨ ਕੀ ਹੁੰਦਾ ਜੀ ਮਤਲਬ ਕਿ ਜਦੋਂ ਪੱਕ ਫਸਲ ਪੱਕਣ 'ਤੇ ਆਏ ਹੋਊਗੀ ਜਿਵੇਂ ਪੱਕਦੀ ਉੱਦੂ ਬਾਅਦ ਮਤਲਬ ਕਿ ਗੜ੍ਹੇਮਾਰੀ ਹੋ ਜਾਂਦੀ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਮਤਲਬ ਵੀ ਕੁਦਰਤੀ ਕਰੋਪੀ ਹੋ ਜਾਂਦੀ ਆ ਗੜ੍ਹੇ ਪੈ ਜਾਂਦੇ ਆ ਜਾਂ ਮੀਂਹ ਜ਼ਿਆਦਾ ਪੈ ਜਾਂਦਾ ਠੀਕ ਹੈ ਜਾਂ ਤੇਜ਼ ਹਵਾ ਚੱਲ ਪੈਂਦੀ ਆ ਉਹ ਮਤਲਬ ਮੀਂਹ ਪੈ ਕੇ ਅਤੇ ਹਵਾ ਦੇ ਕਾਰਨ ਉਹ ਡਿੱਗ ਪੈਂਦੀ ਆ ਜਿਵੇਂ ਕਣਕ ਵਗੈਰਾ ਕੋਈ ਗਲ ਜਾਂਦੀ ਆ ਜਾਂ ਝੋਨਾ ਇਹ ਜਿਵੇਂ ਮਤਲਬ ਮੀਂਹ ਪੈ ਜਾਂਦਾ ਹਵਾ ਚੱਲ ਪੈਂਦੀ ਅਤੇ ਇਹਦੇ ਪ੍ਰੋਬਲਮ ਆਉਂਦੀ ਹੈ ਇਹ ਵੀ ਗਲ ਜਾਂਦੀ ਹੈ ਗਲ ਜਾਂਦਾ ਹੈ ਅਤੇ ਜਿਵੇਂ ਭੁੱਖਮਰੀ ਭੁੱਖਮਰੀ ਜਿਵੇਂ ਜੀ ਇੱਥੇ ਆਪਣੇ ਯੂਪੀ 'ਚ ਆ ਬਿਹਾਰ 'ਚ ਇੱਧਰ ਜੀ ਬਹੁਤ ਜ਼ਿਆਦਾ ਜਿਵੇਂ ਬੱਚੇ ਵੱਧ ਪੈਦਾ ਕਰ ਲੈਂਦੇ ਆ ਅਤੇ ਉਹ ਬੱਚੇ ਵੱਧ ਪੈਦਾ ਕਰ ਕਰ ਲੈਂਦੇ ਆ ਅਤੇ ਉਹਦੇ ਕਾਰਨ ਮਤਲਬ ਕਿ ਵੀ ਉਹਨਾਂ ਤੋਂ ਇੰਨਾ ਖਵਾਇਆ ਪਿਆਇਆ ਨਹੀਂ ਜਾਂਦਾ ਐਨੇ ਪਹੁੰਚ ਨਹੀਂ ਹੁੰਦੀ ਜਾਣੀ ਕਿ ਬੱਚੇ ਵੱਧ ਪੈਦਾ ਕਰਕੇ ਅਤੇ ਉਹਦਾ ਕਰਕੇ ਉਹਦੇ ਨਾਲ ਵੀ ਮਤਲਬ ਕਿ ਜਾਣੀ ਕਿ ਬੱਚਿਆਂ ਨੂੰ ਬਹੁਤ ਹੁੰਦਾ ਗਾ ਅਤੇ ਇਹ ਹੈ ਜੀ ਬਹੁਤ ਕਰਕੇ ਮਤਲਬ ਭੁੱਖਮਰੀ ਕਹਿੰਦੇ ਆ ਥੈਂਕ ਯੂ ਜੀ ਧੰਨਵਾਦ